ਹਾਂਜੀ ਕਿਸਾਨਾਂ ਪੋਲਟੀ ਕਿਸਾਨਾਂ ਵਿੱਚ ਪੋਲਟਰੀ ਫਾਰਮ ਮੁਰਗੀਆਂ ਲਈ ਪ੍ਰਜਨਣ ਦਾ ਪ੍ਰਬੰਧ ਬਹੁਤ ਹੀ ਵਧੀਆ ਹੁੰਦਾ ਹੈ ਜਿਵੇਂ ਕਿ ਅਸੀਂ ਉਹ ਬਹੁਤ ਵਧੀਆ ਵਧੀਆ ਮੁਰਗੀਆਂ ਚੁਣਦੇ ਹਨ ਅਤੇ ਮੁਰਗੇ ਵੀ ਚੁਣਦੇ ਹਨ ਜਿਹਨਾਂ ਨਾਲ ਉਹਨਾਂ ਨੂੰ ਦੋਨਾਂ ਨੂੰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਾ ਲੱਗੀ ਹੋਵੇ ਉਹਨਾਂ ਦਾ ਟੈਸਟ ਕੀਤਾ ਜਾਂਦਾ ਹੈ ਉਹਨਾਂ ਨੂੰ ਟੀਕੇ ਲਗਾਏ ਜਾਂਦੇ ਨੇ ਜਿਹਦੇ ਕਾਰਨ ਉਹ ਐਂਟੀਬੋਟੀਕ ਵਗੈਰਾ ਜਿੰਨੇ ਉਹ ਸਾਫ ਸੁਥਰੇ ਹੁੰਦੇ ਨੇ ਅਤੇ ਸਾਫ ਸੁਥਰੀ ਇਹੀ ਅੱਗੋਂ ਮੁਰਗੀਆਂ ਮੁਰਗੇ ਪੈਦਾ ਹੁੰਦੇ ਨੇ ਜਿਸ ਵਜ੍ਹਾ ਕਾਰਨ ਉਹਨਾਂ ਦੀ ਸਾਥੀਆਂ ਦੀ ਚੋਣ ਬਹੁਤ ਵਧੀਆ ਹੁੰਦੀ ਹੈ ਜੇ ਅਸੀਂ ਆਮ ਜਾਨਵਰ ਦੀ ਦੇਖਭਾਲ ਕਿਵੇਂ ਆਪਾਂ ਦੇਖਭਾਲ ਬਹੁਤ ਵਧੀਆ ਕਰਦੇ ਆ ਜਿਵੇਂ ਕਿ ਸਾਨੂੰ ਉਹਨਾਂ ਨੂੰ ਨਹਿਲਾਣਾ ਚਾਹੀਦਾ ਹੈ ਉਹਨਾਂ ਨੂੰ ਉਹਨਾਂ ਨੂੰ ਦੇਖਣਾ ਚਾਹੀਦਾ ਕੀੜੇ ਉਹਨਾਂ ਦੇ ਨਾ ਪਏ ਹੋਣ ਉਹਨਾਂ ਨੂੰ ਹਰ ਹਫਤੇ 'ਚ ਸਫਾਈ ਕਰਨੀ ਚਾਹੀਦੀ ਹੈ ਦੇਖ ਦੇਖ ਭਾਲ ਕੇ ਕਿਹਾ ਵੀ ਵਧੀਆ ਕਰਦੀ ਹੈ ਕਿ ਨਹੀਂ ਹੁੰਦੇ ਉਹਨਾਂ ਨੂੰ ਸ਼ੈਂਪੂ ਨਾਲ ਨਹਿਲਾਣਾ ਚਾਹੀਦਾ ਮਤਲਬ ਕਿ ਜਾਨਵਰ ਕੋਈ ਹੋਵੇ ਉਹਨਾਂ ਨੂੰ ਸਾਫ ਸੁਥਰਾ ਵਧੀਆ ਅਤੇ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੇ ਟੀਕੇ ਉਹਨਾਂ ਦੇ ਮੁਤਾਬਿਕ ਸਾਨੂੰ ਲਗਾਉਣੇ ਚਾਹੀਦੇ ਹਨ ਜਿੱਦਾਂ ਕਾਰਨ ਉਹ ਵੀ ਸੁਰੱਖਿਅਤ ਰਹਿਣ ਅਤੇ ਅਸੀਂ ਵੀ